ਹਾਂਜੀ ਇੰਸ਼ੋਰੈਂਸ ਕੰਪਨੀ ਤੋਂ ਬੋਲਦੇ ਹੋ ਹੈਲੋ ਹਾਂਜੀ ਇੰਸ਼ੋਰੈਂਸ ਕੰਪਨੀ ਤੋਂ ਬੋਲਦੇ ਹੋ ਜੀ ਹਾਂਜੀ ਜੀ ਮੈਂ ਗੁਰਲੀਨ ਕੌਰ ਬੋਲਦੀ ਸੀ ਜੀ ਅਸੀਂ ਨਾ ਹੈਲਥ ਇੰਸ਼ੋਰੈਂਸ ਦਾ ਕਰਵਾਉਣਾ ਸੀਗਾ ਅਤੇ ਮੈਨੂੰ ਇਹਦੇ ਬਾਰੇ ਦੱਸੋਂਗੇ ਵੀ ਕੀ ਬੈਨੀਫਿਟਸ ਇਨ੍ਹਾਂ ਦਾ ਅਸੀਂ ਚਾਰ ਹਾਂ ਜੀ ਫੈਮਲੀ ਮੈਂਬਰ ਚਾਰਾਂ ਦਾ ਹੀ ਕਰਵਾਉਣਾ ਗਾ ਹੈਂਜੀ ਦੋ ਅਸੀਂ ਹਸਬੈਂਡ ਵਾਈਫ ਹੈ ਦੋ ਗੁੱਡੀਆਂ ਨੇ

ਹੈਲੋ ਹਾਂਜੀ ਹਸਬੈਂਡ ਦੀ ਫੋਟੀ ਹੈ ਜੀ ਉਹ ਨੇ ਜੀ ਹਾਂਜੀ ਹਾਂਜੀ ਔਰ ਹਾਂਜੀ ਹਾਂਜੀ ਸਰਕਾਰੀ ਜੋਬ ਕਰਦੇ ਨੇ ਜੀ ਟੀਚਰ ਨੇ ਜੀ ਬੁਰਜ ਕਲਾਂ ਸਕੂਲ 'ਚ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਅਤੇ ਇਨ੍ਹਾਂ ਦਾ ਕੀ ਕੀ ਪ੍ਰਾਈਜ ਅੱਛਾ ਜੀ

ਅੱਛਾ ਅੱਛਾ ਜੀ ਇਹ ਤਾਂ ਆਪਾਂ ਕਰਵਾ ਲਵਾਂਗੇ ਆਹ ਕਿਉਂਕਿ ਪਤਾ ਹੀ ਹੈ ਤੁਹਾਨੂੰ ਲੈਣਾ ਹੀ ਪੈਂਦਾ ਅਤੇ ਮੈਨੂੰ ਆਹ ਦੱਸੋ ਵੀ ਜੇ ਪਹਿਲਾਂ ਹੀ ਲੈਣਾ ਹੋਵੇ ਫਿਰ ਮਿਲ ਜਾਂਦਾ ਜੀ ਅੱਛਾ ਮਤਲਬ ਵੀ ਦੇਖੋ ਹੁਣ ਆਪਾਂ ਕੋਈ ਇਸ਼ੂ ਆਇਆ ਵਾ ਹੈਲਥ ਦਾ ਅਤੇ ਆਪਾਂ ਟਰੀਟਮੈਂਟ ਕਰਵਾਉਣਾ ਅਤੇ ਕੀ ਪਹਿਲਾਂ ਵੀ ਲੈ ਸਕਦੇ ਹਾਂ ਜੀ ਅੱਛਾ ਜੀ ਅੱਛਾ ਇਹ ਕਿੱਥੇ ਹੈ ਤੁਹਾਡਾ ਉਹ ਓਫਿਸ ਅੱਛਾ ਜੀ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਆਵਾਂਗੇ ਜੀ ਅਸੀਂ ਕੱਲ੍ਹ ਜਾਂ ਪਰਸੋਂ ਤੱਕ ਓਕੇ ਠੀਕ ਹੈ ਚਲੋ ਠੀਕ ਹੈ ਜੀ